ਸਰਕਾਰ ਔਰਤਾਂ ਲਈ ਬਹੁਤ ਕੁਛ ਕਰ ਰਹੀ ਹੈ ਨਵੇਂ ਨਵੇਂ ਤਰੀਕੇ ਦੀ ਸ਼ਿਕਸ਼ਾ ਉਪਲਬਧ ਕਰ ਰਹੀ ਹੈ ਸਰਕਾਰ ਸਕੂਲਾਂ ਦੇ ਵਿੱਚ ਔਰਤਾਂ ਲਈ ਪਲਸ ਟੂ ਤੱਕ ਇਹ ਸ਼ਿਕਸ਼ਾ ਫਰੀ ਕੀਤੀ ਹੋਈ ਹੈ ਇਹ ਜਿਹੜੇ ਲੋਕ ਘਰਾਂ ਦੇ ਵਿੱਚ ਉਹਨਾਂ ਦੇ ਮਾਂ ਬਾਪ ਉਹਨਾਂ ਨੂੰ ਨਹੀਂ ਪੜ੍ਹਾ ਸਕਦੇ ਉਹਨਾਂ ਲਈ ਫਰੀ ਸ਼ਿਕਸ਼ਾ ਮਿਲ ਰਹੀ ਹੈ ਉਹਨਾਂ ਨੂੰ ਅਤੇ ਔਰਤਾਂ ਦੀ ਸਿਹਤ ਲਈ ਉਹਨਾਂ ਨੇ ਸੁਰੱਖਿਆ ਲਈ ਖੂਬ ਆਯੁਸ਼ਮਾਨ ਕਾਰਡ ਖੋਲ ਦਿੱਤੇ ਨੇ ਇਹ ਜਿਹੜੇ ਆਪ ਵਲਿਆਂ ਦੀ ਉਹ ਹੈਗੀ ਐ ਆਪ ਕਲੀਨਿਕ ਉਹ ਖੋਲ ਦਿੱਤੇ ਨੇ ਅਤੇ ਫਰੀ ਕਾਰਡ ਬਣਾ ਦਿੱਤੇ ਗਏ ਨੇ ਅਤੇ ਸਰਕਾਰ ਔਰਤਾਂ ਨੂੰ ਬਹੁਤ ਕੁਛ ਕਰ ਰਹੀ ਹੈ ਬਹੁਤ ਅੱਛੀ ਗੱਲ ਹੈ ਜਿਹੜੀ ਸਾਡੀ ਸਰਕਾਰ ਹੈਗੀ ਐ ਪੰਜਾਬ ਦੀ ਉਹ ਬਹੁਤ ਵਧੀਆ ਔਰਤਾਂ ਲਈ ਸ਼ਿਕਸ਼ਾ ਸਿਹਤ ਵਿਭਾਗ ਸਭ ਵਧੀਆ ਕਰ ਰਹੀ ਹੈ ਉਹਨਾਂ ਨੂੰ ਕਈ ਸਹੂਲਤਾਂ ਮਿਲ ਰਹੀਆਂ ਹਨ ਆਪਣੇ ਆਪਣੇ ਘਰ ਬੈਠੇ ਹੀ ਅਤੇ ਜਿਨ੍ਹਾਂ ਦੇ ਮਾਂ ਪਿਓ ਦੀ ਕੋਈ ਵੀ ਤਨਖਾਵਾਂ ਨਹੀਂ ਹੈਗੀਆਂ ਬਹੁਤੀਆਂ ਉਹਨਾਂ ਦੇ ਬੱਚੇ ਪੜ੍ਹਨ ਤੋਂ ਬੇਰੋਜ਼ਗਾਰ ਸੀਗੇ ਨਹੀਂ ਪੜ ਸਕਦੇ ਸੀ ਨੌਕਰੀਆਂ ਕਰਨ ਤੋਂ ਉਹਨਾਂ ਨੇ ਨੌਕਰੀਆਂ ਵੀ ਖੋਲ ਦਿੱਤੀਆਂ ਹਨ ਕਈ ਤਰ੍ਹਾਂ ਦੀਆਂ ਚੀਜ਼ਾਂ ਸਰਕਾਰ ਨੇ ਔਰਤਾਂ ਲਈ ਕਰ ਦਿੱਤੀਆਂ ਹੈ ਜਿਹੜਾ ਕਿ ਬਹੁਤ ਹੀ ਅੱਛੀ ਗੱਲ ਹੈ ਕਿ ਔਰਤਾਂ ਨੂੰ ਵੀ ਮੌਕਾ ਮਿਲਿਆ ਹੈ ਆਪਣਾ ਪੜ੍ਹਨ ਦਾ ਸਭ ਕੁਛ ਸਿਲਾਈ ਕਢਾਈ ਸਭ ਕੁਛ ਕਰਨ ਦਾ ਧੰਨਵਾਦ